ਹੈਲੋ ਹਾਂ ਹਾਂ ਗੈਸ ਏਜੰਸੀ ਤੋਂ ਬੋਲਦੇ ਹੋ ਹਾਂਜੀ ਜੀ ਉਹ ਮੈਂ ਗੱਲ ਕਰਨੀ ਸੀਗੀ ਅੱਜ ਤੁਸੀਂ ਦੇ ਕੇ ਗਏ ਉਦੋਂ ਤੋਂ ਮੈਂ ਘਰ ਨਹੀਂ ਸੀ ਤਾਂ ਤਾਂ ਹਮ ਅਤੇ ਉਹ ਪਿਛਲਾ ਸਿਲੰਡਰ ਤਾਂ ਸਾਡਾ ਜਮਾਂ ਹੀ ਥੋੜ੍ਹਾ ਚੱਲਿਆ ਅਤੇ ਮੈਨੂੰ ਲੱਗਦਾ ਉਹਦੀ ਵੇਟ 'ਚ ਕੋਈ ਗੜਬੜ ਹੈਗੀ ਹੈ ਨਹੀਂ ਨਹੀਂ ਸਰ ਸਾਡਾ ਤਾਂ ਸਿਲੰਡਰ ਬਹੁਤ ਚੱਲਦਾ ਪਰ ਐਤਕੀ ਤਾਂ ਬੜੇ ਥੋੜ੍ਹੇ ਦਿਨ ਚੱਲਿਆ ਮੈਨੂੰ ਸ਼ੱਕ ਵੀ ਹੋਇਆ ਪਰ ਨਹੀਂ ਪਤਾ ਕਿ ਕੀ ਦਿੱਕਤ ਸੀਗੀ ਕੀ ਦਿੱਕਤ ਨਹੀਂ ਪਰ ਕੋਈ ਕਿੱਥੇ ਨਾ ਕਿਤੇ ਕੋਈ ਗੜਬੜ ਹੈਗੀ ਹੈ ਹਮ ਤੁਸੀਂ ਸ਼ਾਮੀ ਆ ਜਾਂਦੇ ਤਿੰਨ ਚਾਰ ਪੰਜ ਵਜੇ ਹਾਂਜੀ ਚਾਰ ਪੰਜ ਵਜੇ ਮਿਲਦੇ ਤੁਸੀਂ ਕਰੀ ਨਾ ਉਹ ਰੈਗੂਲੇਟਰ ਵੀ ਚੈੱਕ ਕਰ ਹੀ ਲਿਆ ਜੇ ਨਹੀਂ ਜੀ ਦਿੱਕਤ ਤਾਂ ਮੈਨੂੰ ਤਾਂ ਨਹੀਂ ਲੱਗਦੀ ਉੱਪਰ ਤੁਸੀਂ ਕਹਿੰਦੇ ਹੋ ਨਾ ਵੇਟ ਤਾਂ ਘੱਟ ਹੋ ਨਹੀਂ ਸਕਦਾ ਤਾਂ ਮੈਂ ਕਹਿੰਦੀ ਹਾਂ ਕਿ ਇੱਕ ਵਾਰੀ ਚੈੱਕ ਕਰ ਲਿਓ ਹਾਂਜੀ ਠੀਕ ਹੈ ਜੀ